ਹਾਂ ਜਿਹੜੇ ਹੱਥੀਂ ਬੁਣੇ ਹੋਏ ਕੱਪੜੇ ਨਾਲੋਂ ਰੇਡੀਮੈਂਟ ਕੱਪੜੇ ਬਹੁਤ ਅਲੱਗ ਹੁੰਦੇ ਹਨ ਜਿਵੇਂ ਕਿ ਜਿਹੜੇ ਰੇਡੀਮੈਂਟ ਕੱਪੜੇ ਹੁੰਦੇ ਹਨ ਉਹਨਾਂ ਦੀ ਕੁਆਲਿਟੀ ਵਧੀਆ ਨਹੀਂ ਹੁੰਦੀ ਗੀ ਅਤੇ ਉਹਨਾਂ ਵਿੱਚ ਕੱਪੜਾ ਛਿੰਡਣ ਦਾ ਜਾਂ ਰੰਗ ਫਿਟਣ ਦਾ ਖਤਰਾ ਰਹਿੰਦਾ ਹੈ ਤਾਂ ਇਹਦੇ ਨਾਲ ਕੱਪੜਾ ਖਰਾਬ ਵੀ ਹੁੰਦਾ ਹੈ ਅਤੇ ਪਰ ਜਿਹੜਾ ਆਪਣਾ ਹੱਥੀਂ ਬੁਣਿਆ ਹੋਇਆ ਕੱਪੜਾ ਹੁੰਦਾ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਕੋਈ ਖਤਰਾ ਨਹੀਂ ਹੁੰਦਾ ਵੀ ਕੱਪੜਾ ਛਿਟੇਗਾ ਜਾਂ ਕੱਪੜਾ ਫਿਰ ਰੰਗ ਫਿਟੇਗਾ ਵਾ ਚੜ੍ਹ ਜਾਂਦਾ ਕਈ ਕੱਪੜੇ ਇਸ ਤਰ੍ਹਾਂ ਕੱਪੜੇ ਚੜ੍ਹਨ ਦਾ ਡਰ ਨਹੀਂ ਹੁੰਦਾ ਅਸੀਂ ਆਪਣੇ ਹੱਥੀਂ ਬਣਾਉਣ ਦੇ ਹੱਥੀਂ ਕ ਹੱਥੀਂ ਕੱਪੜੇ ਬਣਾਉਣ ਨਾਲ ਵਧੀਆ ਡਿਜ਼ਾਇਨ ਆਪਣੇ ਵੱਲੋਂ ਦੇ ਸਕਦੇ ਹਾਂ ਅਤੇ ਆਪਣੇ ਮਨਪਸੰਦ ਦਾ ਡਿਜ਼ਾਇਨ ਪਵਾ ਸਕਦੇ ਹਾਂ ਅਤੇ ਇਹ ਜ਼ਿਆਦਾ ਸਮੇਂ ਤੱਕ ਚੱਲਣ ਦੀ ਗਰੰਟੀ ਹੁੰਦੀ ਹੈ ਇਸ ਲਈ ਸਾਨੂੰ ਹੱਥੀਂ ਕੱਪੜੇ ਇਸ ਲਈ ਰੈਡੀਮੈਂਟ ਨਾਲੋਂ ਹ ਹੱਥੀਂ ਬੁਣੇ ਹੋਏ ਕੱਪੜੇ ਜ਼ਿਆਦਾ ਖਰੀਦੇ ਜਾਂਦੇ ਹਨ ਜੇਕਰ ਸਾਡੇ ਮਾਰਕੀਟ ਹੈ ਤਾਂ ਅਸੀਂ ਮਾ ਰੇਡੀਮੈਂਟ ਰੇਡੀਮੈਂਟ ਦੀ ਥਾਂ ਆਪਣੇ ਹ ਰੇਡੀ ਹੱਥੀਂ ਕੱਪੜੇ ਬੁਣੇ ਹੋਏ ਜ਼ਿਆਦਾ ਬਾਏ ਕਰਦੇ ਹਾਂ